ਹੈਲੋ ਸਤਿ ਸ਼੍ਰੀ ਅਕਾਲ ਜੀ ਆਪਣੇ ਸਵਿਗੀ ਜਿਨ੍ਹਾਂ ਨਾਲ ਗੱਲ ਕਰਦੇ ਪਏ ਹਾਂ ਹਾਂਜੀ ਹਾਂਜੀ ਭਾਅ ਜੀ ਮੈਂ ਨਾ ਆਪਣੇ ਔਡਰ ਕਰਵਾਇਆ ਸੀ ਸਵੀਗੀ ਤੋਂ ਹਾਂਜੀ ਭਾਅ ਜੀ ਮੈਂ ਔਡਰ ਕਰਵਾਇਆ ਸੀ ਆਪਣੇ ਦਾਲ ਮੱਖਣੀ ਮਟਰ ਪਨੀਰ ਅਤੇ ਦੋ ਸੋਫਟ ਡਰਿੰਕਾਂ ਅਤੇ ਆਪਣੇ ਮਿੱਠੇ 'ਚ ਆਪਣੇ ਖੀਰ ਔਡਰ ਕਰਾਈ ਸੀ ਹਾਂਜੀ ਭਾਅ ਜੀ ਭਾਅ ਜੀ ਇਹ ਜਿਹੜਾ ਆਪਣੇ ਮਟਰ ਪਨੀਰ ਇਹ 'ਚ ਤਾਂ ਨਮਕ ਹੀ ਬੜਾ ਸੀ ਸਾਡੇ ਘਰ ਪਾਰਟੀ ਸੀ ਅਤੇ ਸਾਡੇ ਘਰ ਕੋਈ ਵੀ ਇੰਨਾ ਮਸਾਲੇ ਵਾਲਾ ਖਾਂਦਾ ਹੀ ਨਹੀਂ ਆ ਅਤੇ ਜਿਹੜੀ ਖੀਰ ਸੀਗੀ ਉਹ ਤਾਂ ਮਿੱਠੀ ਅ ਮਿੱਠੀ ਬੜੀ ਸੀ ਇੰਨਾ ਮਿੱਠਾ ਪਾਇਆ ਸੀ ਕਿ ਕੋਈ ਹਿਸਾਬ ਹੀ ਨਹੀਂ ਸੀ ਹਾਂਜੀ ਭਾਅ ਜੀ ਉਤੋਂ ਜਿਹੜੀ ਦੋ ਸੋਫਟ ਡਰਿੰਕਾਂ ਮੰਗਵਾਈਆਂ ਸੀ ਮਿੰਟ ਫਲੇਵਰ 'ਚ ਮੰਗਵਾਈਆਂ ਸੀ ਅਤੇ ਤੁਸੀਂ ਮੈਨੂੰ ਆਹ ਕੋਕਾ ਕੋਲਾ ਅਤੇ ਫੈਂਟਾ ਭੇਜ ਦਿੱਤੀ ਆ ਹਾਂਜੀ ਭਾਅ ਜੀ ਕੀ ਮਤਲਬ ਐਵੇਂ ਵੀ ਗੱਲ ਥੋੜ੍ਹੀ ਨਾ ਕਿ ਮਤਲਬ ਅਸੀਂ ਔਡਰ ਕਰਾਈਏ ਅਤੇ ਤੁਸੀਂ ਗਲਤ ਭੇਜ ਦਿਓ ਸਮਾਨ ਕਿ ਸਾਡੇ ਘਰ ਦੇ ਪਹਿਲੇ ਵੀ ਗੱਲ ਤਾਂ ਮਟਰ ਪਨੀਰ ਤਾਂ ਕੋਈ ਇੰਨਾ ਨਮਕ ਵਾਲਾ ਖਾਂਦਾ ਨਹੀਂ ਅਤੇ ਤੁਸੀਂ ਮਿੱਠਾ ਉਸ 'ਚ ਇੰਨਾ ਜ਼ਿਆਦਾ ਪਾ ਦਿੱਤਾ ਖੀਰ 'ਚ ਤਾਂ ਕੋਈ ਹਿਸਾਬ ਏ ਨਹੀਂ ਅਤੇ ਹੁਣ ਤੁਸੀਂ ਇੱਦਾਂ ਕੰਮ ਕਰੋ ਕਿ ਮੇਰਾ ਜਾਂ ਤਾਂ ਤੁਸੀਂ ਰਿਟਰਨ ਕਰਵਾ ਕੇ ਦਿਓ ਜਾਂ ਰਿਪਲੇਸ ਕਰਵਾ ਕੇ ਦਿਓ ਹਾਂਜੀ ਭਾਅ ਜੀ ਰਿਟਰ ਅ ਰਿਟਰਨ ਨਹੀਂ ਲਓਗੇ ਆਪਣੇ ਰਿਫੰਡ ਕਰ ਦਿਓਗੇ ਪੈਸੇ ਠੀਕ ਆ ਭਾਅ ਜੀ ਰਿਫੰਡ ਤਾਂ ਚਲੋ ਤੁਸੀਂ ਕਰ ਦਿਓਗੇ ਪਰ ਅਸੀਂ ਮੈਂ ਇਹਦਾ ਔਡਰ ਦਾ ਕਰਾਂਗਾ ਕੀ ਜਿਹੜਾ ਤੁਸੀਂ ਆਹ ਮੈਨੂੰ ਦਿੱਤੇ ਦਾ ਕਿਉਂਕਿ ਸਾਡੇ ਘਰ ਨਾ ਕੋਈ ਵੀ ਨਾ ਕੋਈ ਖਾਂਦਾ ਵਾ ਅੱਜ ਨਾਲੇ ਪਾਰਟੀ ਸੀਗੀ ਜੀ ਨਾਲੇ ਇੱਦਾਂ ਹੋ ਗਿਆ ਚਲੋ ਤੁਸੀਂ ਵੇਖ ਲਓ ਫਿਰ ਕੀ ਕਰਨਾ ਕਿ ਮਤਲਬ ਤੁਸੀਂ ਆਹ ਔਡਰ ਕਿਸੇ ਹੋਰ ਨੂੰ ਦੇ ਦਿਓ ਅਤੇ ਮੈਨੂੰ ਨਵਾਂ ਔਡਰ ਔਡਰ ਦੇ ਦਿਓ ਜਾਂ ਫਿਰ ਚਲੋ ਠੀਕ ਆ ਤੁਸੀਂ ਰਿਫੰਡ ਦੇ ਦਿਓ ਅਤੇ ਬਾਕੀ ਆਹ ਲੈ ਜਿਓ ਤੁਸੀਂ ਇੱਥੋਂ ਆ ਕੇ ਹਾਂਜੀ